ਹੈਲੋ ਸਵੀਗੀ ਤੋਂ ਬੋਲਦੇ ਪਏ ਜੇ ਭਾਅ ਜੀ ਮੈਂ ਅੋਡਰ ਕੀਤਾ ਸੀਗਾ ਸਾਡੇ ਘਰ ਵੀਹ ਵੀਹ ਕੁ ਬੰਦਿਆਂ ਦਾ ਪ੍ਰੋਗਰਾਮ ਸੀਗਾ ਅਤੇ ਅੋਡਰ ਕੀਤਾ ਸੀਗਾ ਅਤੇ ਮੈਂ ਜਾਣਨ ਲਈ ਫੋਨ ਕੀਤਾ ਸੀ ਕਿ ਤੁਸੀਂ ਸਾਡਾ ਅੋਡਰ ਜਿਹੜਾ ਉਹ ਐਕਸੈਪਟ ਕਰ ਲਿਆ ਵਾ ਅਤੇ ਉਹਦੇ ਵਿੱਚ ਕੁਝ ਆਈਟਮਾਂ ਮੈਂ ਲਿਖੀਆਂ ਹੋਈਆਂ ਸੀਗੀਆਂ ਵਕ ਉਹਦੇ ਵਿੱਚ ਇੱਕ ਪੀਜਾ ਸੀਗਾ ਬਰਗਰ ਸੀ ਨਾਨ ਸੀਗੇ ਅਤੇ ਹੋਰ ਪਨੀਰ ਪਨੀਰ ਸੀਗਾ ਅਤੇ ਹੋਰ ਹੁਣ ਮੈਂ ਇੱਕ ਪਿੰਡ ਤੋਂ ਬੋਲਦੀ ਪਈ ਹਾਂ ਅਤੇ ਭਾਅ ਜੀ ਸਾਡਾ ਆਡਰ ਨਹੀਂ ਹੈ ਮੈਂ ਇਹ ਜਾਣਨਾ ਹੈ ਕਿ ਕਿੱਥੋਂ ਕੁ ਤੱਕ ਪਹੁੰਚਿਆ ਆ ਅਤੇ ਤੁਸੀਂ ਪਲੀਜ਼ ਜਲਦੀ ਜਲਦੀ ਤੋਂ ਜਲਦੀ ਸਾਡਾ ਆਡਰ ਜਿਹੜਾ ਉਹ ਪੁਹੰਚਾ ਦਿਓ ਕਿਉਂਕਿ ਸਾਡੇ ਘਰ ਫਿਰ ਬਹੁਤ ਦੇਰ ਹੋ ਜਾਣੀ ਆ